ਮੇਰੇ ਕੋਲ ਪੋਟਰੀ ਵਿੱਚ ਬੱਤਖਾਂ ਹਨ ਬੱਤਖਾਂ ਮੇਰੇ ਕੋਲ ਗਿਣਤੀ ਵਿੱਚ ਦਸ ਹਨ ਜੋ ਕਿ ਮੇਰੇ ਕਾਰੋਬਾਰ ਵਿੱਚ ਮੇਰੀ ਬਹੁਤ ਮਦਦ ਹੁੰਦੀ ਹੈ ਇਸ ਨਾਲ ਨਾ ਕਿ ਮੈਨੂੰ ਸਿਰਦਰਦੀ ਹੁੰਦੀ ਹੈ ਅਤੇ ਮੈਂ ਉਹਨਾਂ ਦੀ ਸਾਂਭ ਵੀ ਕਰ ਸਕਦੀ ਹਾਂ ਅਤੇ ਸਮੇਂ ਸਮੇਂ 'ਤੇ ਉਨਾਂ ਦੀ ਦੇਖਭਾਲ ਪੂਰੀ ਤਰ੍ਹਾਂ ਕਰਦੀ ਹਾਂ